ਮੈਨੂੰ ਧਾਰਮਿਕ ਅਸਥਾਨਾਂ ਗੁਰਦੁਆਰਿਆਂ ਗੁਰਦੁਆਰਿਆਂ ਵਿੱਚ ਜਾਣਾ ਬਹੁਤ ਹੀ ਪਸੰਦ ਹੈ ਮੈਂ ਇੱਕ ਵਾਰ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਸੀ ਉੱਥੇ ਅਸੀਂ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਅਸੀਂ ਮੱਥਾ ਟੇਕਿਆ ਉੱਥੇ ਬਹੁਤ ਹੀ ਜ਼ਿਆਦਾ ਰੱਸ਼ ਸੀ ਅਤੇ ਅਸੀਂ ਲੰਗਰ ਉੱਥੇ ਬਹੁਤ ਹੀ ਜ਼ਿਆਦਾ ਰੱਸ਼ ਸੀ ਉੱਥੇ ਮੱਥਾ ਟੇਕ ਕੇ ਮੇਰੇ ਮਨ ਦੇ ਬਹੁਤ ਹੀ ਜ਼ਿਆਦਾ ਦੁੱਖ ਦੂਰ ਹੋਏ ਅਤੇ ਅਸੀਂ ਲੰਗਰ ਛਕਿਆ ਉੱਥੇ ਅਸੀਂ ਬਹੁਤ ਹੀ ਜ਼ਿਆਦਾ ਸ਼ੋਪਿੰਗ ਕੀਤੀ ਅਤੇ ਅਸੀਂ ਜਲ੍ਹਿਆਂਵਾਲਾ ਬਾਗ ਵੀ ਦੇਖ ਕੇ ਆਏ ਮਤਲਬ ਕਿ ਅਸੀਂ ਉੱਥੇ ਬਹੁਤ ਜ਼ਿਆਦਾ ਫੋਟੋਗ੍ਰਾਫੀ ਵੀ ਕੀਤੀ ਬਹੁਤ ਹੀ ਉੱਥੇ ਘੁੰਮ ਕੇ ਸਾਨੂੰ ਮਤਲਬ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਤੋਂ ਇਲਾਵਾ ਮੈਂ ਸਮੁੰਦਰ ਸਮੁੰਦਰ ਜਾਣਾ ਵੀ ਬਹੁਤ ਪਸੰਦ ਕਰਦੀ ਹਾਂ ਮੈਨੂੰ ਪਾਣੀ ਪਾਣੀ ਵਿੱਚ ਘੁੰਮਣਾ ਵੀ ਬਹੁਤ ਪਸੰਦ ਹੈ ਰਿਸ਼ਤੇਦਾਰਾਂ ਦੇ ਘਰ ਜਾਣਾ ਰਿਸ਼ਤੇਦਾਰ ਮੇਰੇ ਨਾਨਕੇ ਰਿਸ਼ਤੇਦਾਰਾਂ ਦੇ ਘਰ ਮੈਨੂੰ ਜਾਣਾ ਬਹੁਤ ਪਸੰਦ ਹੈ ਅਤੇ ਅਸੀਂ ਬਹੁਤ ਹੀ ਜ਼ਿਆਦਾ ਖੇਡਦੇ ਹਾਂ ਬਹੁਤ ਹੀ ਜ਼ਿਆਦਾ ਇੰਨਜੁਆਏ ਕਰਦੇ ਹਾਂ ਬਹੁਤ ਅਤੇ ਬਹੁਤ ਹੀ ਜ਼ਿਆਦਾ ਘੁੰਮਣ ਲਈ ਜਾਂਦੇ ਹਾਂ ਅਤੇ ਉਹ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਸਾਡੀ ਹਰ ਗੱਲ ਵਿੱਚ ਸਾਥ ਦਿੰਦੇ ਹਨ ਹਰ ਗੱਲ ਦਾ ਸਾਥ ਦਿੰਦੇ ਹਨ ਅਤੇ ਸਾਡਾ ਹਰ ਗੱਲ ਦਾ ਸਾਥ ਦਿੰਦੇ ਹਨ ਅਤੇ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ